ਪੁਰਾਣੇ ਸਮੇਂ ਵਿੱਚ ਆਵਾਜਾਈ ਦੇ ਸਾਧਨ ਬਹੁਤ ਘੱਟ ਹੁੰਦੇ ਸੀਗੇ ਅਤੇ ਰਸਤੇ ਵਗੈਰਾ ਵੀ ਕੱਚੇ ਹੁੰਦੇ ਸੀ ਹੁਣ ਸੜਕਾਂ ਵਗੈਰਾ ਤਾਂ ਬਹੁਤ ਵਧੀਆ ਬਣ ਗਈਆਂ ਅਤੇ ਆਵਾਜਾਈ ਲਈ ਮਸ਼ੀਨਰੀ ਵੀ ਹੁਣ ਬਹੁਤ ਜ਼ਿਆਦਾ ਹੋ ਚੁੱਕੀ ਆ ਗੱਡੀਆਂ ਕਾਰਾਂ ਸੜਕਾਂ 'ਤੇ ਹੁਣ ਬਹੁਤ ਦੌੜ ਰਹੀਆਂ ਨੇ ਜਿਹਦੇ ਨਾਲ ਹੁਣ ਜਾਣੀ ਕਿ ਜਿਹੜੀ ਸਿਹਤ ਸੰਭਾਲ ਆ ਜਿਵੇਂ ਕੋਈ ਐਕਸੀਡੈਂਟ ਹੋ ਜਾਵੇ ਐਬੂਲੈਂਸ ਵਗੈਰਾ ਆ ਜਾਂਦੀ ਹੈ ਬਹੁਤ ਜਲਦੀ ਅਤੇ ਸਿੱਖਿਆ ਦੇ ਖੇਤਰ 'ਚ ਵੀ ਬੜੀ ਹੁਣ ਤਰੱਕੀ ਹੋ ਗਈ ਆ ਪਹਿਲਾਂ ਪੁਰਾਣੇ ਸਮਿਆਂ 'ਚ ਸਕੂਲ ਜਿਹੜੇ ਸੀਗੇ ਉਹਨਾਂ ਦੀ ਸੰਖਿਆ ਬਹੁਤ ਘੱਟ ਸੀਗੀ ਦੂਸਰੇ ਪਾਸੇ ਜਿਹੜੇ ਨੌਕਰੀ ਦੇ ਭਾਲ ਦੇ ਮੌਕੇ ਆ ਹੁਣ ਪਹਿਲਾਂ ਨਾਲੋਂ ਕਾਫੀ ਵੱਧ ਚੁੱਕੇ ਨੇ ਅਤੇ ਬਾਕੀ ਹੁਣ ਜਿਹੜਾ ਨੇੜਲੇ ਸ਼ਹਿਰ ਆ ਜਾਂ ਕਸਬੇ ਨੇ ਇਹ ਬਹੁਤ ਹੁਣ ਜੁੜੇ ਹੋਏ ਨੇ ਮਤਲਬ ਜਿਹੜੀ ਆਵਾਜਾਈ ਦੇ ਸਾਧਨਾਂ ਨਾਲ ਹੁਣ ਆਵਾਜਾਈ ਵਧੀਆ ਜਿਵੇਂ ਪੁਰਾਣੇ ਸਮੇਂ 'ਚ ਤਾਂ ਬਹੁਤ ਔਖਾ ਹੁੰਦਾ ਸੀ ਕੰਮ ਇਹ ਸਾਰਾ ਇਸ ਲਈ ਹੁਣ ਬਹੁਤ ਪਹਿਲਾਂ ਨਾਲੋਂ ਜਿਹੜੀ ਤਰੱਕੀ ਹੋ ਚੁੱਕੀ ਹੈ ਅਤੇ ਬੜਾ ਹੁਣ ਪਹਿਲਾਂ ਨਾਲੋਂ ਤਾਂ ਜਿਹੜੀ ਆ ਸਾਰੇ ਦੇਸ਼ ਨੂੰ ਬੜਾ ਇਹਦੇ ਨਾਲ ਲਾਭ ਪੁੱਜਿਆ ਬਾਕੀ ਆਵਾਜਾਈ ਦੇ ਸਾਧਨ ਹੁਣ ਪੂਰੇ ਨੇ ਹੁਣ ਪਹਿਲਾਂ ਨਾਲੋਂ ਤਾਂ ਪਹਿਲਾਂ ਤਾਂ ਤਾਂਗੇ ਵਗੈਰਾ ਹੁੰਦੇ ਸੀ ਹੌਲੀ ਚੱਲਣ ਵਾਲੇ ਸਾਧਨ ਹੁੰਦੇ ਸੀਗੇ ਅਤੇ ਹੁਣ ਗੱਡੀਆਂ ਨੇ ਬੜੀ ਸਪੀਡ ਨਾਲ ਚੱਲਣ ਵਾਲੀਆਂ ਨੇ ਹੁਣ ਅਸੀਂ ਆਪਣੇ ਸਥਾਨ 'ਤੇ ਕਿਤੇ ਵੀ ਨਿਸ਼ਚਿਤ ਸਥਾਨ 'ਤੇ ਬਹੁਤ ਜਲਦੀ ਪਹੁੰਚ ਸਕਦੇ ਐਂ ਅਤੇ ਸ਼ਹਿਰਾਂ ਦੇ ਨਾਲ ਪਿੰਡ ਜੁੜ ਚੁੱਕੇ ਨੇ ਇਸ ਲਈ ਹੁਣ ਕੋਈ ਬਾਹਲਾ ਔਖਾ ਨਹੀਂ ਹੈਗਾ